ਹੈਲੋ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਪੰਜਾਬ ਦੀ ਜਿਹੜੀ ਮੁੱਖ ਭਾਸ਼ਾ ਹੈ ਉਹ ਪੰਜਾਬੀ ਹੈ ਪੰਜਾਬੀ ਕਿਸ ਤਰ੍ਹਾਂ ਸਿੱਖੀ ਅਸੀਂ ਸ਼ੁਰੂ ਤੋਂ ਹੀ ਨਾ ਪਰਿਵਾਰ ਦੇ ਵਿੱਚ ਪੰਜਾਬੀ ਹੀ ਬੋਲਦੇ ਪੰਜਾਬੀ 'ਚ ਹੀ ਗੱਲਬਾਤ ਕਰਦੇ ਇਸ ਲਈ ਸ਼ੁਰੂ ਤੋਂ ਹੀ ਆਸਾਨੀ ਨਾਲ ਪੰਜਾਬੀ ਸਿੱਖ ਲਈ ਜਦੋਂ ਵੱਡੇ ਹੋਏ ਨਾ ਪੰਜਾਬੀ ਫਿਰ ਸਕੂਲ ਦੇ ਵਿੱਚ ਨਾ ਦਾਖਲਾ ਹੋਇਆ ਉੱਥੇ ਅਸੀਂ ਪੂਰੀ ਲਗਾਂ ਮਾਤਰਾ ਨਾਲ ਪੰਜਾਬੀ ਸਿੱਖੀ ਵਿਆਕਰਨ ਸਿੱਖੀ ਇਸ ਲਈ ਪੰਜਾਬੀ ਬੋਲਣੀ ਲਿਖਣੀ ਸਿੱਖ ਲਈ ਅਤੇ ਇਸ ਬਾਰੇ ਜਿਹੜਾ ਅਨੁਭਵ ਹੈ ਨਾ ਉਹ ਤਾਂ ਇਹ ਵਾ ਕਿ ਪੰਜਾਬੀ ਭਾਸ਼ਾ ਜਿਹੜੀ ਬਹੁਤ ਹੀ ਵਧੀਆ ਭਾਸ਼ਾ ਹੈ ਪੰਜਾਬੀ ਨੂੰ ਪੂਰੇ ਵਰਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਹੋਇਆ ਅਤੇ ਪੰਜਾਬੀ ਭਾਸ਼ਾ ਜਿਹੜੀ ਹੈ ਹੁਣ ਤਾਂ ਪੰਜਾਬ ਦੇ ਨਾਲ ਨਾਲ ਜਿਹੜੀ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਵੀ ਹੀ ਪੰਜਾਬੀ ਵੱਲ ਜ਼ਿਆਦਾ ਉਹਨਾਂ ਦਾ ਰੁਝਾਨ ਵਧਿਆ ਵੱਧ ਗਿਆ ਉਹ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਪੜ੍ਹਨੀ ਲਿਖਣੀ ਵੀ ਬੋਲਣੀ ਪਸੰਦ ਕਰਦੇ ਨੇ ਕਿਉਂਕਿ ਸਾਡੇ ਗੁਰੂਆਂ ਪੀਰਾਂ ਦੀ ਭਾਸ਼ਾ ਵਾ ਇਸ ਲਈ ਪੰਜਾਬ 'ਚ ਤਾਂ ਪੰਜਾਬੀ ਹੀ ਬੋਲੀ ਜਾਂਦੀ ਹੈ ਪਰ ਹੁਣ ਬਾਹਰਲੇ ਦੇਸ਼ਾਂ 'ਚ ਵੀ ਜਿਸ ਤਰ੍ਹਾਂ ਉਹਨਾਂ ਨੇ ਵਿਸ਼ਾ ਪੰਜਾਬੀ ਦਾ ਜਿਹੜਾ ਉਹ ਲਾਜ਼ਮੀ ਕਰ ਦਿੱਤਾ ਹੋਇਆ ਹੈ ਕਈ ਯੂਨੀਵਰਸਿਟੀਆਂ ਸਕੂਲ ਜਿਹੜੇ ਉਹ ਪੰਜਾਬੀ ਸਬਜੈਕਟ ਜਿਹੜਾ ਉਹ ਲਾਉਂਦੇ ਅਤੇ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ ਇਸ ਲਈ ਪੰਜਾਬੀ ਭਾਸ਼ਾ ਦੀ ਜਿਹੜੀ ਬਹੁਤ ਹਰਮਨ ਪਿਆਰੀ ਭਾਸ਼ਾ ਬਣ ਗਈ ਹੈ ਹਾਂਜੀ ਧੰਨਵਾਦ